ਮੇਰਾ ਰੋਲ ਮਾਡਲ ਜਿਹੜਾ ਪੰਛੀ ਹੈ ਉਹ ਮੋਰ ਹੈ ਅਤੇ ਮੋਰ ਜਿਹੜਾ ਇੱਕ ਪੰਜਾਬੀ ਸੱਭਿਆਚਾਰਕ ਦਾ ਸਭ ਤੋਂ ਮਸ਼ਹੂਰ ਪੰਛੀ ਹੈ ਅਤੇ ਇਹਦੇ ਜਿਹੜੇ ਖੰਭ ਆ ਬੜੇ ਚਮਕਦਾਰ ਹੁੰਦੇ ਹੈ ਅਤੇ ਇਹਨੂੰ ਅਸੀਂ ਜ਼ਿਆਦਾਤਰ ਪਿੰਡਾਂ ਦੇ ਪੰਜਾਬ ਦੇ ਪਿੰਡਾਂ ਵਿੱਚ ਦੇਖਦੇ ਹਾਂ ਅਤੇ ਮੌਨਸੂਨ ਦੇ ਮੌਸਮ ਵਿੱਚ ਹੁੰਦਾ ਅਤੇ ਜਦੋਂ ਇਹ ਖੁਸ਼ੀ ਵਿੱਚ ਆਪਣੇ ਪੰਖ ਖਿਲਾਰਦਾ ਅਤੇ ਨੱਚਦਾ ਅਤੇ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਹਮੇਸ਼ਾ ਹੀ ਖੁਸ਼ੀ ਦਾ ਪ੍ਰਤੀਕ ਜ਼ਾਹਰ ਕਰਦਾ ਇਹਦੇ ਬੜੇ ਸੁੰਦਰ ਖੰਭ ਲੰਬੇ ਹੁੰਦੇ ਹੈ ਅਤੇ ਇਹਦੇ ਜਿਹੜੇ ਖੰਭਾਂ ਦੇ ਆਪਾਂ ਸੁੰਦਰ ਸੁੰਦਰ ਪੰਖੇ ਵੀ ਬਣਾਉਂਦੇ ਹਾਂ ਇਹਦੇ ਸਿਰ 'ਤੇ ਕਲਗੀ ਹੁੰਦੀ ਹੈ ਜਿਹੜੀ ਦੇਖਣ 'ਚ ਬਹੁਤ ਸੋਹਣੀ ਲੱਗਦੀ ਹੈ ਅਤੇ ਜਦੋਂ ਕਿਤੇ ਆਕਾਸ਼ ਵਿੱਚ ਬੱਦਲ ਆਉਂਦੇ ਆ ਤਾਂ ਖੁਸ਼ ਹੋ ਕੇ ਪੈਲਾਂ ਪਾਉਂਦਾ ਤਦ ਮਨ ਨੂੰ ਬੜੀ ਇੱਕ ਖੁਸ਼ੀ ਮਿਲਦੀ ਹੈ ਅਤੇ ਵਧੀਆ ਲੱਗਦਾ ਹੈ ਮੋਰ ਜਿਹੜਾ ਇਹਦਾ ਇੱਕ ਟਿਕਾਣਾ ਮਤਲਬ ਬਚਿੱਤਰ ਜਿਹਾ ਹੈ ਇਹ ਰੁੱਖਾਂ 'ਤੇ ਵੀ ਚੜ੍ਹ ਚ ਜਾਂਦਾ ਹੈ ਅਤੇ ਇਹ ਬੜਾ ਹੀ ਸੋਹਣਾ ਪੰਛੀ ਹੈ ਮੇਰੇ ਹਿਸਾਬ ਦੇ ਨਾਲ ਇਹ ਹਰ ਇੱਕ ਦਾ ਰੋਲ ਮਾਡਲ ਹੋਣਾ ਹੈ ਆਪਣੇ ਪੰਜਾਬ ਦੇ ਵਿੱਚ